ਹਾਂਜੀ ਮੈਂ ਤੁਹਾਡੇ ਰੈਸਟੋਰੈਂਟ 'ਚ ਆਈ ਤਾਂ ਸੂਪ ਇੱਥੇ ਬਹਿ ਕੇ ਪੀਣ ਸੀਗੀ ਪਰ ਕੀ ਹੋਇਆ ਕਿ ਐਕਚੁਅਲੀ ਮੈਨੂੰ ਅਚਾਨਕ ਫੋਨ ਆ ਗਿਆ ਤਾਂ ਹੁਣ ਮੈਨੂੰ ਜਲਦੀ 'ਚ ਘਰ ਜਾਣਾ ਪਵੇਗਾ ਅਤੇ ਮੈਂ ਸੂਪ ਜੋ ਔਡਰ ਕੀਤਾ ਸੀਗਾ ਕਿਰਪਾ ਕਰਕੇ ਉਹਨੂੰ ਚੰਗੀ ਤਰ੍ਹਾਂ ਪੈਕ ਕਰ ਦਿਓ ਅਤੇ ਪੈਕਜਿੰਗ ਇੱਦਾਂ ਦੀ ਕਰਿਓ ਕਿ ਜਿਹੜਾ ਸੂਪ ਹੈ ਨਾ ਜਲ ਜਲਦੀ ਠੰਡਾ ਹੋਵੇ ਅਤੇ ਨਾ ਹੀ ਲੀਕ ਹੋਵੇ ਕਿਉਂਕਿ ਜੇ ਸੂਪ ਠੰਡਾ ਹੋ ਗਿਆ ਤਾਂ ਉਹਦਾ ਕੋਈ ਸਵਾਦ ਨਹੀਂ ਰਹਿਣਾ ਅਤੇ ਮੇਰੇ ਘਰ ਦਾ ਰਸਤਾ ਇੱਥੋਂ ਘੰਟੇ ਦਾ ਆ ਅਤੇ ਸੜਕ ਵੀ ਬਹੁਤ ਭੀੜ ਵਾਲੀ ਹੁੰਦੀ ਹੈ ਜਿਸ ਕਰਕੇ ਕਿ ਜਲਦੀ ਪਹੁੰਚਣਾ ਮੁਸ਼ਕਿਲ ਹੈ ਅਤੇ ਸੂਪ ਠੰਡਾ ਨਾ ਹੋ ਜਾਵੇ ਰਸਤੇ 'ਚ ਇਸ ਕਰਕੇ ਇਹਦੀ ਪੈਕਜਿੰਗ ਚੰਗੀ ਤਰ੍ਹਾਂ ਕਰ ਦਿਓ ਬਾਕੀ ਜੇ ਇਸਦੇ ਐਕਸਟਰਾ ਚਾਰਜਿਸ ਹੈਗੇ ਨੇ ਤਾਂ ਉਹ ਵੀ ਪਲੀਜ਼ ਮੈਨੂੰ ਦੱਸ ਦਿਓ ਅਤੇ ਮੈਂ ਉਹ ਵੀ ਪੇ ਕਰ ਦਾਂਗੀ